ਮੈਂ ਬਚਪਨ ਵਿੱਚ ਹੀ ਚਿੱਤਰਕਾਰੀ ਸ਼ੁਰੂ ਕਰ ਦਿੱਤੀ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਸਕੂਲ ਵਿੱਚ ਸਾਡੇ ਅਧਿਆਪਕ ਨੇ ਸਾਨੂੰ ਇੱਕ ਤਸਵੀਰ ਚਿੱਤਰਕਾਰੀ ਕਰਨ ਨੂੰ ਕਿਹਾ ਜੋ ਕਿ ਮੈਂ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਮੇਰੇ ਅਧਿਆਪਕ ਨੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਜਿਸ ਕਰਕੇ ਮੈਨੂੰ ਚਿੱਤਰਕਾਰੀ ਵਿੱਚ ਦਿਲਚਸਪੀ ਹੋਣ ਲੱਗੀ ਮੇਰਾ ਮਨ ਪਸੰਦ ਕਲਾਕਾਰ ਗਿੱਪੀ ਗਰੇਵਾਲ ਹੈ ਜਦੋਂ ਵੀ ਮੈਂ ਵਿਹਲੀ ਹੁੰਦੀ ਹਾਂ ਉਸ ਦੀ ਤਸਵੀਰ ਬਣਾਉਂਦੀ ਹਾਂ ਮੈਂ ਹਰ ਤਰ੍ਹਾਂ ਦੀ ਚਿੱਤਰਕਾਰੀ ਕਰ ਸਕਦੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰੀ ਚਿੱਤਰਕਾਰੀ ਹਰ ਕੋਈ ਜਾਣੇ ਅਤੇ ਮੇਰਾ ਨਾਮ ਵੀ ਮਸ਼ਹੂਰ ਹੋਵੇ ਮੈਨੂੰ ਚਿੱਤਰਕਾਰੀ ਕਰਨਾ ਬਹੁਤ ਹੀ ਚੰਗਾ ਲੱਗਦਾ ਹੈ